ਹੈਲੋ ਸਤਿ ਸ੍ਰੀ ਅਕਾਲ ਜੀ ਤੁਸੀਂ ਹੀਰੋ ਸਾਈਕਲ ਤੋਂ ਹੋ ਗੱਲ ਕਰ ਰਹੇ ਹੋ ਮੈਂ ਨਾ ਆਪਣੇ ਬੇਟੇ ਲਈ ਸਾਈਕਲ ਦੇਖਣਾ ਸੀਗਾ ਤੇ ਮੈਨੂੰ ਕਿਸੇ ਨੇ ਤੁਹਾਡੀ ਰੈਫਰੈਂਸ ਦਿੱਤੀ ਹੈ ਮੈਂ ਮੇਰੇ ਬੇਟੇ ਲਈ ਮੇਰੇ ਬੇਟੇ ਦੀ ਉਮਰ ਪੰਦਰਾਂ ਸਾਲ ਤੱਕ ਦੀ ਹੈਗੀ ਆ ਮੇਰਾ ਬਜਟ ਨਾ ਦਸ ਤੋਂ ਉੱਪਰ ਦਾ ਨਹੀਂ ਹੈਗਾ ਜੀ ਅੱਛਾ ਦੇਖੋ ਲੈਣਾ ਤਾ ਮੈਂ ਸਪੈਸ਼ਲ ਤੇ ਵਧੀਆ ਹੀ ਹੈ ਮੇਰੇ ਬੇਟੇ ਨੇ ਸਪੈਸ਼ਲੀ ਕਿਹਾ ਮੈਨੂੰ ਤੁਹਾਡੀ ਰੈਫਰੈਂਸ ਕਿਸੇ ਬਹੁਤ ਖਾਸ ਬੰਦੇ ਨੇ ਦਿੱਤੀ ਹ ਮੈਂ ਤੁਹਾਨੂੰ ਉਹਦੀ ਡਿਟੇਲ ਮਿਲ ਕੇ ਵੀ ਦੇ ਦਾਂਗੀ ਹੁਣ ਤੁਸੀਂ ਮੇਰਾ ਕੀ ਮਾਣ ਕਰੋਗੇ ਮੇਰੀ ਇੱਕ ਤੁਹਾਨੂੰ ਬਹੁਤ ਗੁਜ਼ਾਰਿਸ਼ ਹੈ ਕਿ ਜਿਹੜਾ ਤੁਸੀਂ ਆਪਣਾ ਬਾਰਾਂ ਤੇਰਾਂ ਹਜਾਰ ਦੀ ਰੇਂਜ ਵਾਲਾ ਸਾਈਕਲ ਹ ਮੈਨੂੰ ਕਿੰਨੇ ਦਾ ਲਾ ਦੋਗੇ ਚਲੋ ਅੱਛਾ ਮੈਨੂੰ ਇੱਕ ਹੋਰ ਗੱਲ ਦੱਸੋ ਤੁਸੀਂ ਮੇਰੇ ਘਰ ਭਿਜਵਾ ਦੋਗੇ ਕਿ ਮੈਨੂੰ ਚੱਕਣ ਵਾਲਾ ਪਏਗਾ ਸਾਈਕਲ ਦੇਖ ਕੇ ਪਤਾ ਕੀ ਭੈਣਜੀ ਮੇਰੇ ਨਾ ਬੇਟੇ ਨੇ ਨਾ ਚੂਜ ਕੀਤਾ ਪਸੰਦ ਕੀਤਾ ਹੋਇਆ ਹੋਇਆ ਜੇ ਮੈਂ ਤੁਹਾਨੂੰ ਫੋਟੋ ਭੇਜ ਦੇਵਾਂ ਤਾਂ ਉਹਦੇ ਨਾਲ ਕੰਮ ਨਹੀਂ ਹੋ ਸਕਦਾ ਅੱਛਾ ਤੇ ਜੇ ਅਸੀਂ ਚਲੋ ਮੈਂ ਪੂਰੀ ਕੋਸ਼ਿਸ਼ ਕਰਦੀ ਆ ਜੈਸੇ ਪਹੁੰਚ ਜਾਈਏ ਤੁਹਾਡਾ ਸ਼ਨੀਵਾਰ ਤੇ ਰਵੀ ਇਤਵਾਰ ਨੂੰ ਖੁੱਲਾ ਹੁੰਦਾ ਤੇ ਸ਼ਨੀਵਾਰ ਜੇ ਅਸੀਂ ਜਿਦਾਂ ਨਾ ਅਸ ਅਸੀਂ ਕਾਫੀ ਦੂਰ ਤੋਂ ਆਉਣਾ ਤੁਹਾਡੇ ਉਥੇ ਤੇ ਜੇ ਲੇਟ ਹੋ ਜਾਈਏ ਤਾਂ ਤੁਸੀਂ ਮਿਲ ਲਵੋਗੇ ਸਾਨੂੰ ਲੇਟ ਵੀ ਮੈਨੂੰ ਨਾ ਮੇਰੇ ਬੇਟੇ ਨੂੰ ਸਪੈਸ਼ਲੀ ਲਾਲ ਰੰਗ ਦਾ ਚਾਹੀਦਾ ਪਰ ਆਹ ਦੇਖ ਲਿਓ ਤੁਸੀਂ ਉਹ ਇਦਾਂ ਦੇ ਹੋਏਗਾ ਤੁਹਾਡੇ ਕੋਲ ਵਰਾਇਟੀ ਤੇ ਕਾਠੀ ਤੇ ਬਿਨਾਂ ਵਾਲਾ ਪਸੰਦ ਕਰੇਗਾ ਉਹ ਤੇ ਜੇ ਕੁਝ ਉਹਨੇ ਲਵਾਣਾ ਹੋਇਆ ਉਹ ਤੁਸੀਂ ਦੇ ਸਕਦੇ ਹੋ ਨਾਲ ਲਗਵਾ ਕੇ ਉਹ ਸਾਨੂੰ ਵੇਟ ਤਾਂ ਨਹੀਂ ਕਰਨੀ ਪਏਗੀ ਤੁਹਾਨੂੰ ਉਸੇ ਦਿਨ ਦੇ ਰਹੋਗੇ ਕਿ ਬਾਅਦ ਚੋਂ ਆਉਣਾ ਪਏਗਾ ਚਲੋ ਚੰਗਾ ਭੈਣ ਜੀ ਫਿਰ ਅਸੀਂ ਮਿਲਦੇ ਆ